ਜੀ ਹਾਂ ਸਕੂਲ ਅਤੇ ਕੋਲਜ ਵਿੱਚ ਵੱਖ ਵੱਖ ਕੋਰਸ ਕਰਦੇ ਸਮੇਂ ਅਸੀਂ ਚਿੱਤਰਕਾਰੀ ਵੀ ਸਿੱਖਦੇ ਹਾਂ ਸਕੂਲ ਦੇ ਵਿੱਚ ਮੁੱਢਲੀਆਂ ਕਲਾਸਾਂ ਤੋਂ ਹੀ ਚਿੱਤਰਕਾਰੀ ਸਿਖਾਈ ਜਾਂਦੀ ਹੈ ਕੋਲਜ ਦੇ ਵਿੱਚ ਵੀ ਸਾਨੂੰ ਅਲੱਗ ਤੋਂ ਇੱਕ ਆਪਸ਼ਨ ਹੁੰਦੀ ਹੈ ਜਿਸ ਵਿੱਚ ਅਸੀਂ ਚਿੱਤਰਕਾਰੀ ਨਾਲ ਸੰਬੰਧਿਤ ਸਬਜੈਕਟ ਰੱਖ ਸਕਦੇ ਹਾਂ ਇਹ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਬਹੁਤ ਸਾਰੇ ਵੋਕੇਸ਼ਨਲ ਕੋਰਸ ਚਲਾਉਂਦੀ ਹੈ ਜਿਸ ਰਾਹੀਂ ਬੱਚੇ ਚਿੱਤਰਕਾਰੀ ਨੂੰ ਚੰਗੀ ਤਰ੍ਹਾਂ ਸਿੱਖ ਸਕਦੇ ਹਨ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਜਿੱਥੇ ਕਿ ਚਿੱਤਰਕਾਰੀ ਨਾਲ ਸੰਬੰਧਿਤ ਅਲੱਗ ਅਲੱਗ ਕੋਰਸ ਸਿਖਾਏ ਜਾਂਦੇ ਹਨ ਆਪਣੀ ਕਲਾ ਕੈਰੀਅਰ ਦੇ ਟੀਚੇ ਨੂੰ ਪੂਰਾ ਕਰਨ ਲਈ ਮੈਂ ਵੀ ਚਿੱਤਰਕਾਰੀ ਵਿੱਚ ਬਹੁਤ ਕੋਸ਼ਿਸ਼ ਕੀਤੀ ਜਿਸ ਨਾਲ ਮੈਂ ਟੈਟੂ ਬਣਾਉਣਾ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਮੈਂ ਇਸਨੂੰ ਚੰਗੀ ਤਰ੍ਹਾਂ ਸਿੱਖ ਸਕਾਂ